ਮੈਂ ਘਰ ਵਿੱਚ ਬਾਗ਼ਬਾਨੀ ਕਰਦੀ ਹਾਂ ਆਪਣੇ ਘਰ ਵਿੱਚ ਪੌਦੇ ਲਗਾ ਕੇ ਰੱਖੇ ਹੋਏ ਹਨ ਇਹਨਾਂ ਤੋਂ ਸਾਨੂੰ ਹਰਿਆਲੀ ਵੀ ਮਿਲਦੀ ਹੈ ਅਤੇ ਆਕਸੀਜਨ ਵੀ ਮਿਲਦੀ ਹੈ ਬਾਕੀ ਜੋ ਘਰ ਵਿੱਚ ਵਰਤੋਂ ਵਿੱਚ ਲਿਆਂਦੀ ਗਈ ਚੀਜ਼ ਹੈ ਜੋ ਪੁਦੀਨਾ ਧਣੀਆ ਮੇਥੀ ਐਲੋ ਵੇਰਾ ਇਹ ਸਾਡੀ ਸਕਿੱਨ ਲਈ ਵੀ ਬਹੁਤ ਅੱਛਾ ਹੈ ਐਲੋ ਵੇਰਾ ਅਤੇ ਪੁਦੀਨਾ ਸਾਡੇ ਖਾਣ ਵਿੱਚ ਕੰਮ ਆਉਂਦਾ ਹੈ ਮੇਥੀ ਸਾਡੇ ਖਾਣ ਦੇ ਵਿੱਚ ਕੰਮ ਆਉਂਦੀ ਹੈ ਇਹ ਚੀਜ਼ਾਂ ਨੂੰ ਅਸੀਂ ਘਰ ਵਿੱਚ ਵਰਤਦੇ ਹਾਂ ਬਾਕੀ ਸਾਡੇ ਜੋ ਫੁੱਲ ਪੌਦੇ ਰੱਖੇ ਹੋਏ ਨੇ ਉਹਨਾਂ ਦੇ ਫੁੱਲ ਖਿੜਦੇ ਆਂ ਬਹੁਤ ਅੱਛਾ ਮਹਿਸੂਸ ਹੁੰਦਾ ਫੁੱਲ ਖਿੜਦਾ ਜਦੋਂ ਦੇਖ ਕੇ ਬਹੁਤ ਅੱਛਾ ਲੱਗਦਾ ਹੈ ਅਤੇ ਪੌਦੇ ਬਹੁਤ ਜ਼ਿਆਦਾ ਲਗਾਉਣੇ ਚਾਹੀਦੇ ਹੈ ਇਨ੍ਹਾਂ ਨਾਲ਼ ਸਾਨੂੰ ਆਕਸੀਜਨ ਮਿਲਦੀ ਹੈ